ਮੈਂ ਆਪਣੇ ਡਾਂਸ ਰੂਟੀਨ ਲਈ ਸੰਗੀਤ ਦੀ ਚੋਣ ਵੱਖਰੇ ਵੱਖਰੇ ਤਰੀਕੇ ਨਾਲ ਕਰਦੀ ਹਾਂ ਇਸ ਦੇ ਲਈ ਕੁਝ ਨਿਯਮ ਹਨ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗੀ ਹਾਂ ਕੀ ਤੁਸੀਂ ਕਿਸੇ ਤਰ੍ਹਾਂ ਤੁਸੀਂ ਆਪਣੇ ਡਾਂਸ ਦੀ ਸਹੀ ਢੰਗ ਨਾਲ ਚੋਣ ਕਰ ਸਕਦੇ ਹੋ ਆਪਣੇ ਡਾਂਸ ਰੂਟੀਨ ਲਈ ਸੰਗੀਤ ਦੀ ਚੋਣ ਕਰਦੇ ਸਮੇਂ ਕਈ ਜ਼ਰੂਰੀ ਅੰਗਾਂ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੁੰਦਾ ਹੈ ਪਹਿਲਾ ਸੰਗੀਤ ਦੀਆਂ ਧੁਨੀਆਂ ਅਤੇ ਬਾਟਾਂ ਦਾ ਡਾਂਸ ਦੇ ਸਟਾਈਲ ਨਾਲ ਮੇਲ ਮਿਲਾਪ ਕਰਨਾ ਜ਼ਰੂਰੀ ਹੁੰਦਾ ਉਦਾਹਰਣ ਵਜੋਂ ਜੇ ਤੁਸੀਂ ਭੰਗੜਾ ਜਾਂ ਕਲਾਸੀਕਲ ਡਾਂਸ ਕਰਦੇ ਹੋ ਰਹਿੰਦੇ ਹੋ ਤਾਂ ਤੁਹਾਨੂੰ ਪਰੰਪਰਾਰਿਕ ਤੌਰ 'ਤੇ ਖੂ ਖੁਸ਼ਬੂਦਾਰ ਅਤੇ ਉਤਸਾਹਕ ਸੰਸ ਸੰਗੀਤ ਦੀ ਜ਼ਰੂਰਤ ਪਵੇਗੀ ਇਸ ਤੋਂ ਇਲਾਵਾ ਜੇ ਤੁਸੀਂ ਜਾਂ ਹਿਪ ਹੋ ਹੋਪ ਡਾਂਸ ਕਰ ਰਹੇ ਹੋ ਤਾਂ ਮਜ਼ੇਦਾਰ ਅਤੇ ਉਤਸ਼ਾਹ ਮਿਊਜਿਕ ਦੇ ਨਾਲ ਸੰਗੀਤ ਦੀ ਚੋਣ ਕਰਨੀ ਚਾਹੀਦੀ ਹੈ ਜੋ ਰਿਦਮਕ ਅਤੇ ਤੇਜ਼ ਹੋਵੇ ਇਹ ਵੀ ਜ਼ਰੂਰੀ ਹੈ ਕਿ ਸੰਗੀਤ ਦਾ ਦੁਹਰਾਓ ਸੈ ਸੈਕਸ਼ਨ ਅਤੇ ਬਿਲਡ ਅਪ ਪੁਰਾਣੀ ਡਾਂਸ ਦੇ ਕੋਰੀਓਗ੍ਰਾਫੀ ਨੂੰ ਸੁਹਾਵਣਾ ਬਣਾਵੇ ਇਸ ਦੇ ਨਾਲ ਸੰਗੀਤ ਦੀ ਲਿਸ਼ਕ ਅਤੇ ਥਿਮ ਨੂੰ ਵੀ ਵਿਚਾਰਨਾ ਚਾਹੀਦਾ ਕਿਉਂਕਿ ਇਹ ਪ ਪੈਸੇ ਦੀ ਮੂੜ ਅਤੇ ਕਹਾਣੀ ਨੂੰ ਬਿਆਨ ਕਰਦਾ ਹੈ ਜੋ ਡਾਂਸ ਰੂਟੀਨ ਦੀ ਨੂੰ ਪੂਰਾ ਕਰ ਸਕਦਾ ਹੈ ਚੋਣ ਕੀਤੀ ਸੰਗੀਤ ਨੂੰ ਚੁਣਨ ਅਤੇ ਉਸ ਦੇ ਨਾਲ ਕਿੱਦਾਂ ਨੱਚਣ ਤੋਂ ਪਹਿਲਾਂ ਇਹਨਾਂ ਦੇ ਵਿਭਿੰਨ ਭਾਗਾਂ ਨੂੰ ਪਰਖਣਾ ਚਾਹੀਦਾ ਹੈ ਤਾਂ ਜੋ ਤੁਸੀਂ ਇਹ ਸਮਝ ਸਕਦੇ ਹੋ ਕਿ ਕਿੱਥੇ ਚੰਗੇ ਫੀਲ ਅਤੇ ਸਟੈ ਸਟੈਪ ਆਸ਼ੁਵਾਦ ਕਰਨੇ ਕਰਨਗੇ ਸੰਗੀਤ ਦੀ ਚੋਣ ਕਰਨ ਦੇ ਸਮੇਂ ਤੁਸੀਂ ਆਪਣੇ ਸਟੇਜ ਦੀ ਸਥਿਤੀ ਅਤੇ ਪ੍ਰਦਰਸ਼ਨ ਦੇ ਪ੍ਰਕਾਰ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੁੰਦੇ ਹੋ ਮੁਰਤੇ ਦਿੱਤੇ ਗਏ ਸੰਗੀਤ ਅਤੇ ਲੇ ਲੇਟੈਸਟ ਓ ਅਖੇ ਮੋਹਮੈਂਟ ਨੂੰ ਹਾਈਲਾਈਟ ਕਰਨ ਵਿੱਚ ਸਹਾਇਤਾ ਹੁੰਦੀ ਹੈ ਜਿਵੇਂ ਕਿ ਡਾਂਸ ਹੈ ਅਤੇ ਮਿਲਡ ਅਪ ਕਨੈਕਸ਼ਨ ਅਤੇ ਪਲਸੀ ਕਲਮਮਾਲਿਕ ਹੁਣ ਇਨਾ ਤੱਤਾਂ ਨੂੰ ਵਿਚਾਰ ਕਰਕੇ ਇਸ ਇੱਕ ਅਦਭੁਤ ਅਤੇ ਪ੍ਰਭਾਵਸ਼ਾਲੀ ਡਾਂਸ ਰੁਟੀਨ ਤਿਆਰ ਕਰ ਸਕਦੇ ਹੋ ਜੋ ਸੰਗੀਤ ਦੇ ਹਰ ਹਿੱਸੇ ਨਾਲ ਸੁਹਾਵਣੇ ਢੰਗ ਨਾਲ ਮਿਲਦਾ ਹੈ ਅਤੇ ਦਰਸ਼ਕਾਂ ਨੂੰ ਪ੍ਰੇਰਿਤ ਕਰਦਾ ਹੈ